ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਿੱਗੀ ਤੋਂ ਗੱਲ ਕਰ ਰਹੇ ਹੋ ਮੇਰਾ ਆਰਡਰ ਸੀ ਜੀ ਇੱਕ ਇੱਕ ਪੀਜ਼ਾ ਅਤੇ ਦੋ ਲੀਟਰ ਵਾਲੀ ਕੋਲਡ ਡਰਿੰਕ ਮੈਂ ਇਸ ਦਾ ਪੂਰਾ ਪੇਅ ਕਰ ਚੁੱਕਾ ਹਾਂ ਜੀ ਮੇਰਾ ਇਹ ਆਰਡਰ ਕਦੋਂ ਤੱਕ ਮੇਰੇ ਤੱਕ ਪਹੁੰਚ ਜਾਵੇਗਾ ਹੋ ਸਕਦਾ ਤਾਂ ਤੁਸੀਂ ਮੈਨੂੰ ਆਪਣੀ ਡਿਲੀਵਰੀ ਬੋਆਏ ਦਾ ਸੰਪਰਕ ਦੇ ਸਕਦੇ ਹੋ ਮੈਂ ਉਸ ਨਾਲ ਸੰਪਰਕ ਕਰਕੇ ਪਤਾ ਕਰ ਸਕਾਂ ਕਿ ਉਹ ਕਿੱਥੇ ਪਹੁੰਚ ਗਿਆ ਹੈ ਮੈਂ ਬਹੁਤ ਸਮੇਂ ਤੋਂ ਉਸਦੀ ਵੇਟ ਕਰ ਰਿਹਾ ਹਾਂ ਅਗਰ ਉਹ ਜਲਦੀ ਪਹੁੰਚਦਾ ਹੈ ਅਤੇ ਅਸ ਮੈਂ ਅਤੇ ਮੇਰਾ ਦੋਸਤ ਆਪਦੇ ਇਸ ਔਡਰ ਦੀ ਵੇਟ ਕਰ ਰਹੇ ਹਾਂ ਕਿਉਂਕਿ ਅਸੀਂ ਸੁਭਾ ਦੇ ਭੁੱਖੇ ਬੈਠੇ ਹਾਂ ਕਿਰਪਾ ਕਰਕੇ ਜਿੰਨੀ ਵੀ ਜਲਦੀ ਹੋ ਸਕਦਾ ਹੈ ਉਸ ਨਾਲ ਸੰਪਰਕ ਕਰੋ ਜਾਂ ਸਾਡਾ ਆਡਰ ਜਲਦੀ ਜਲਦੀ ਪਹੁੰਚਾਓ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਆਡਰ ਖਰਾਬ ਵੀ ਹੋ ਸਕਦਾ ਹੈ ਬੇਨਤੀ ਹੈ ਉਸ ਨਾਲ ਸੰਪਰਕ ਕਰੋ ਅਤੇ ਜਾਂ ਉਸਦਾ ਸੰਪਰਕ ਦਿਉ ਅਸੀਂ ਜਲਦੀ ਜਲਦੀ ਆਪਣਾ ਆਡਰ ਪ੍ਰਾਪਤ ਕਰ ਸਕੀਏ ਸ਼ੁਕਰੀਆ